ਸਤਿ ਸ਼੍ਰੀ ਅਕਾਲ ਸ਼ਰਮਾ ਜੀ ਅੱਜ ਸਵੇਰੇ ਹੀ ਮੈਨੂੰ ਆਪਣੇ ਮੋਬਾਈਲ ਭੁਗਤਾਨ ਦੇ ਬਿਲ ਦਾ ਮੈਸੇਜ ਆਇਆ ਪਰ ਮੈਨੂੰ ਇਸ ਉੱਪਰ ਜਰਾ ਵੀ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਕਿੰਨੀ ਜ਼ਿਆਦਾ ਬੇਈਮਾਨੀ ਚੱਲੀ ਹੋਈ ਹੈ ਇੱਕ ਮਿੰਟ ਨਹੀਂ ਲੱਗਦਾ ਬੈਂਕ ਦੇ ਖਾਤੇ ਨੂੰ ਸਾਫ ਹੋਣ ਵਿੱਚ ਅਤੇ ਹੁਣ ਮੈਂ ਤਾਂ ਪੂਰਾ ਚੋਕੰਨਾ ਰਹਿੰਦਾ ਹਾਂ ਮੈਂ ਤਾਂ ਬੇਗਾਨਾ ਫੋਨ ਵੀ ਨਹੀਂ ਚੱਕਦਾ ਕਿ ਪਤਾ ਲੱਗੇ ਕੌਣ ਲੁਟੇਰਾ ਹੋਵੇ ਮੈਂ ਚੌਦ੍ਹਾਂ ਤਰੀਕ ਨੂੰ ਨਵਾਂ ਫੋਨ ਲਿਆ ਸੀ ਹੁਣ ਦੁਕਾਨ ਵਾਲਿਆਂ ਤੋਂ ਹੀ ਪੁੱਛ ਕੇ ਆਵਾਂਗਾ ਕਿ ਅਸਲ ਗੱਲ ਕੀ ਹੈ ਕਿਉਂਕਿ ਮੈਂ ਦਸ ਹਜ਼ਾਰ ਰੁਪਏ ਦਾ ਫੋਨ ਜਿਸ ਦੀਆਂ ਪੰਜ ਕਿਸ਼ਤਾਂ ਬਣੀਆਂ ਸਨ ਦੋ ਦੋ ਹਜ਼ਾਰ ਦੀਆਂ ਮੈਂ ਉਸ ਦੀ ਤਿੰਨ ਕਿਸ਼ਤਾਂ ਜਮ੍ਹਾਂ ਕਰਵਾ ਚੁੱਕਾ ਹਾਂ ਜਦੋਂ ਚੌਥੀ ਕਿਸ਼ਤ ਭਰਨੀ ਸੀ ਤਾਂ ਉਸ ਤੋਂ ਦੋ ਦਿਨ ਪਹਿਲਾਂ ਮੈਨੂੰ ਇੱਕ ਮੈਸੇਜ ਹੁੰਦਾ ਹੈ ਪਰ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਹੁਣ ਸਮਝਦਾਰ ਹੋ ਚੁੱਕੇ ਹਾਂ ਧੰਨਵਾਦ